ਅਸੀਂ ਤਾਂ ਬ ਖੇਤ ਬਾਗਵਾਨੀ ਆਪਣੇ ਘਰ ਦੇ ਵਿਹੜੇ ਵਿੱਚ ਕਰਦੇ ਹਾਂ ਉਹਦੇ ਵਿੱਚ ਅਸੀਂ ਨਿੰਬੂ ਸੰਤਰਾ ਖੱਟੀ ਜੇ ਬੁੱਝੇ ਲਾਏ ਹਨ ਔਰ ਉਹਨਾਂ ਦੇ ਪਹਿਲਾਂ ਲਾਉਣ ਤੋਂ ਪਲੇਨ ਨੂੰ ਬਣਾ ਕੇ ਦੋ ਫੁੱਟ ਦਾ ਲ ਚੌੜਾ ਅਤੇ ਦੇ ਫੁੱਟ ਦਾ ਡੂੰਘਾ ਟੋਆ ਪੱਟ ਕੇ ਮਿੱਟੀ ਦੇ ਵਿੱਚ ਖਾਦ ਰਲਾ ਕੇ ਪਾ ਦਈ ਜਾਂਦੀ ਹੈ ਜਦੋਂ ਮੀਂਹ ਦਾ ਮੌਸਮ ਆਉਂਦਾ ਉਦੋਂ ਇਹਨਾਂ ਬੂਝਿਆਂ ਨੂੰ ਲਿਆ ਕੇ ਉਹਨਾਂ ਟੋਇਆ ਦੇ ਵਿੱਚ ਲਾ ਦਿੰਦੇ ਹਾਂ ਬੜੇ ਸੋਹਣੇ ਬੂਝੇ ਹੋ ਜਾਂਦੇ ਹਨ ਬਾਗਵਾਨੀ ਇੱਕ ਬਹੁਤ ਵਧੀਆ ਧੰਦਾ ਹੈ ਜਿਹੜੀ ਥੋੜ੍ਹੇ ਥਾਂ ਦੇ ਵਿੱਚ ਜ਼ਿਆਦਾ ਕਮਾਈ ਕਰ ਦਿੰਦੀ ਹੈ ਜਿਵੇਂ ਹੁਣ ਨਿੰਬੂ ਹੈ ਸੱਤਰ ਅੱਸੀ ਰੁਪਈਏ ਕਿੱਲੋ ਵਿਕਦੇ ਨੇ ਅਤੇ ਪੰ ਦੋ ਬੂਟਿਆਂ ਨਾਲ ਘੱਟੋ ਘੱਟ ਚਾਲੀ ਪੰਜਾਹ ਕੁ ਕਿਲੋ ਉਹਨਾਂ ਦੇ ਨਿੰਬੂ ਹੈਗੇ ਨੇ ਆਉਂਦੇ ਨੇ ਸਾਡੇ ਕੋਲੋਂ ਘਰੋਂ ਵੀ ਆ ਕੇ ਲੈ ਜਾਂਦੇ ਨੇ ਲੋੜਵੰਦ ਅਸੀਂ ਕਿਤੇ ਮੰਡੀ ਲੈ ਕੇ ਨਹੀਂ ਗਏ ਜਿਵੇਂ ਜਿਵੇਂ ਸੰਤਰਿਆਂ ਦੇ ਬੂਝੇ ਨੇ ਅਤੇ ਖੱਟੀਆਂ ਦੇ ਬੂਝੇ ਨੇ ਖੱਟੀਆਂ ਤਾਂ ਜਿਹੜੇ ਅਚਾਰ ਪਾਉਣ ਦੇ ਚਾਹਵਾਨ ਹੁੰਦੇ ਨੇ ਉਹ ਲੈ ਜਾਂਦੇ ਨੇ ਖੱਟੀ ਬਹੁਤ ਸਸਤੀ ਵਿਕਦੀ ਹੈ ਕਿਉਂਕਿ ਕਿਤੇ ਬਾਹਲੀ ਜ਼ਿਆਦਾ ਲੋੜ ਵਿੱਚ ਨਹੀਂ ਹੁੰਦੀ ਬੂਝੇ ਲਾ ਲਏ ਹੁਣ ਪੱਟਣ ਨੂੰ ਜੀਅ ਨਹੀਂ ਕਰਦਾ ਅਤੇ ਨਿੰਬੂ ਸਭ ਤੋਂ ਵਧੀਆ ਚੀਜ਼ ਹੈ ਨਿੰਬੂ ਲੱਗ ਜਾਣ ਤਾਂ ਵੱਧ ਤੋਂ ਵੱਧ ਕਮਾਈ ਹੁੰਦੀ ਹੈ ਇਵੇਂ ਜਿਵੇਂ ਦੋ ਬੂਝੇ ਜਾਮਣਾਂ ਦੇ ਨੇ ਜਾਮਣਾਂ ਵੀ ਐਤਕੀ ਗਰਮੀ ਦੇ ਕਰਕੇ ਨਹੀਂ ਲੱਗੀਆਂ ਪਰ ਇਹ ਵੀ ਬੂਝੇ ਬਹੁਤ ਠੀਕ ਹੈ ਇਹ ਸ਼ੂਗਰ ਵਾਸਤੇ ਠੀਕ ਹੈ ਜਾਮਣ ਇਹਦੀਆਂ ਹਰੜਾਂ ਦੀ ਇਹਦੀ ਗੁੱਦ ਵੀ ਖਾਣ ਦੇ ਕੰਮ ਆਉਂਦੀ ਹੈ ਅਤੇ ਬਾਗਬਾਨੀ ਇੱਕ ਚੰਗਾ ਧੰਦਾ ਜੇ ਕੋਈ ਕਰ ਲਏ ਤਾਂ ਵਧੀਆ ਥੋੜ੍ਹੀ ਜਗ੍ਹਾ ਦੇ ਵਿੱਚ ਮਤਲਬ ਦੋ ਕੁ ਸੌ ਗਜ ਦੇ ਵਿੱਚ ਇੱਕ ਕਿੱਲੇ ਜਿੰਨੀ ਫ਼ਸਲ ਇਹ ਦੇ ਦਿੰਦੀਆਂ ਦੇਖਭਾਲ ਦੇ ਨਾਲ ਇਹਨਾਂ ਨੂੰ ਕੋਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਕੋਈ ਇਹਨਾਂ ਨੂੰ ਜ਼ਿਆਦਾ ਰੇਹ ਸਪਰੇ ਦੀ ਲੋੜ ਨਹੀਂ ਇਹ ਬਹੁਤ ਵਧੀਆ ਇੱਕ ਧੰਦਾ ਹੈ ਜਿਹੜੀ ਕਿ ਘਰ ਦੇ ਵਿੱਚ ਹੀ ਲੱਗ ਜਾਂਦੀ ਹੈ